ਖੇਡਾਂ ਦੇ ਵਿੱਚ ਆਏਂ ਹੈ ਨਾ ਵੀ ਟੀਕੇ ਇੰਜੈਕਸ਼ਨਸ ਜਾਂ ਗਲਤ ਦਵਾਈਆਂ ਦਾ ਇਸਤੇਮਾਲ ਕਰਨਾ ਜਾਂ ਆਪਣੇ ਤੁਹਾਡੇ ਪ੍ਰੋਡਕਟੀਵਿਟੀ ਵਧਾਉਣ ਵਾਲੀਆਂ ਇੰਜੈਕਸ਼ਨਸ ਲਵਾਣਾ ਬਹੁਤ ਹੀ ਜ਼ਿਆਦਾ ਗਲਤ ਹੈ ਅਤੇ ਕਿਤੇ ਨਾ ਕਿਤੇ ਇਹ ਇੱਕ ਗਰੀਡ ਰਹਿੰਦੀ ਹੈ ਫਸਟ ਆਉਣ 'ਤੇ ਜਾਂ ਜੋ ਕਿ ਇਹ ਚੀਜ਼ਾਂ ਵੱਲ ਧੱਕਦੀ ਹੈ ਇੱਕ ਖਿਡਾਰੀ ਨੂੰ ਲੇਕਿਨ ਜਿਹੜਾ ਚੰਗਾ ਖਿਡਾਰੀ ਹੁੰਦਾ ਉਹ ਇਹ ਸਭ ਤੋਂ ਦੂਰ ਹੁੰਦਾ ਪਤਾ ਹੁੰਦਾ ਉਹਨੂੰ ਵੀ ਇਹ ਚੀਜ਼ਾਂ ਗਲਤ ਨੇ ਤਾਂ ਕਰਕੇ ਉਸ ਚੀਜ਼ ਤੋਂ ਦੂਰ ਰਹਿੰਦਾ ਖਿਡਾਰੀਆਂ ਨੂੰ ਇਹ ਸਭ ਚੀਜ਼ਾਂ ਤੋਂ ਦੂਰ ਰੱਖਣ ਲਈ ਜਾਂ ਇਹ ਚੀਜ਼ਾਂ ਬਾਰੇ ਦੱਸਣ ਲਈ ਵੀ ਕਿਹੜੀ ਚੀਜ਼ ਸਹੀ ਹੈ ਕਿਹੜੀ ਨਹੀਂ ਤਾਂ ਉਹ ਚੀਜ਼ ਲਈ ਬਕਾਇਦਾ ਸ ਰੂਲਜ਼ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਆ ਅਤੇ ਉਹ ਖਿਡਾਰੀਆਂ ਨੂੰ ਸਾਰੇ ਰੂਲਜ਼ ਐਂਡ ਰੈਗੂਲੇਸ਼ਨਸ ਪਤਾ ਹੋਣੇ ਚਾਹੀਦੇ ਇਕੱਲੀ ਇਕੱਲੀ ਚੀਜ਼ 'ਤੇ ਵੀ ਕੀ ਚੀਜ਼ ਜ਼ਰੂਰੀ ਹੈ ਕਿ ਨਹੀਂ ਕਿਹਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹਨੇ ਨਹੀਂ ਪਾਲਣਾ ਕੀਤੀ ਹੈਗੀ ਆ ਜਿਹੜਾ ਕੋਈ ਵੀ ਇੱਦਾਂ ਦਾ ਕੰਮ ਕਰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨੂੰ ਮੁੜ ਕੇ ਅੱਗੇ ਕਦੇ ਵੀ ਖਿਡਾਉਣਾ ਨਹੀਂ ਚਾਹੀਦਾ